ਸਾਡੇ ਘਰ ਦੇ ਆਲੇ ਦੁਆਲਿਆਂ ਦੇ ਇਲਾਕਿਆਂ ਨੂੰ ਸਾਫ ਰੱਖਣ ਲਈ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਜਿਸ ਲਈ ਮੈਂ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਕਹਿੰਦੀ ਹਾਂ ਕਿ ਸਫਾਈ ਕਰੋ ਸਫਾਈ ਰੱਖਣ ਨਾਲ ਸਾਡੇ ਘਰ ਦੇ ਆਸ ਪਾਸ ਗੰਦ ਨਹੀਂ ਆਉਂਦਾ ਹੈ ਅਤੇ ਸਾਫ ਸੁਥਰਾ ਰਹਿੰਦਾ ਹੈ ਜਿਸ ਦੇ ਲਈ ਮੈਂ ਆਸ ਪਾਸ ਦੇ ਵਿੱਚ ਡਸਟਬਿਨ ਵੀ ਲਗਾਏ ਹਨ ਜਿਸ ਦੇ ਵਿੱਚ ਸਾਰਾ ਕੂੜਾ ਕਰਕਟ ਪਾਇਆ ਜਾਂਦਾ ਹੈ ਨਾਲ ਗਿੱਲਾ ਸੁੱਕਾ ਹਰ ਤਰ੍ਹਾਂ ਦੇ ਡਿਸਟਬਿਨ ਮੈਂ ਅਲੱਗ ਅਲੱਗ ਤਰ੍ਹਾਂ ਦੇ ਰੱਖੇ ਹੋਏ ਹਨ ਆਸ ਪੜੋਸ ਸਾਫ ਰੱਖਣ ਦੇ ਨਾਲ ਸਾਡੇ ਆਸ ਪਾਸ ਸਫਾਈ ਹੀ ਰਹਿੰਦੀ ਹੈ ਅਤੇ ਨਾਲ ਨਾਲ ਸਾਡੇ ਇਲਾਕੇ ਦੇ ਵਿੱਚ ਸਫਾਈ ਦਾ ਬਹੁਤ ਵਧੀਆ ਕੰਮ ਹੋ ਜਾਂਦਾ ਹੈ ਆਸ ਆਪਣੇ ਘਰ ਦੇ ਆਲੇ ਦੁਆਲੇ ਮੈਂ ਪੇੜ ਪੌਦੇ ਵੀ ਲਗਾਏ ਹਨ ਜਿਸ ਦੀ ਵੀ ਸਫਾਈ ਰੋਜ਼ ਕੀਤੀ ਜਾਂਦੀ ਹੈ ਪੇੜ ਪੌਦਿਆਂ ਦੀ ਸਾਫ ਸਫਾਈ ਵੀ ਕੀਤੀ ਜਾਂਦੀ ਹੈ ਜਿਸ ਲਈ ਧਿਆਨ ਮੈਂ ਖੁਦ ਆਪ ਰੱਖਦੀ ਹਾਂ ਪੇੜਾਂ ਦੀ ਸਾਫ ਸਫਾਈ ਦੇ ਨਾਲ ਨਾਲ ਮੈਂ ਆਸ ਪੜੋਸ ਦੀ ਵੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਦੀ ਹਾਂ ਰੋਜ਼ ਆਉਂਦਾ ਕੂੜਾ ਚੱਕਣ ਵਾਲਾ ਕੂੜਾ ਰੋਜ਼ ਚੱਕ ਕੇ ਲੈ ਕੇ ਜਾਂਦਾ ਹੈ ਅਤੇ ਆਸ ਪੜੋਸ ਦੇ ਲੋਕਾਂ ਨੂੰ ਵੀ ਮੈਂ ਸਲਾਹ ਦਿੰਦੀ ਹਾਂ ਕਿ ਆਸ ਪਾਸ ਸਫਾਈ ਰੱਖੋ ਜਿਸ ਦੇ ਨਾਲ ਸਾਡਾ ਹਰ ਪਾਸੇ ਇਲਾਕਾ ਸਾਫ ਸੁਥਰਾ ਰਹਿੰਦਾ ਹੈ ਅਤੇ ਪੂਰੇ ਏਰੀਏ ਦੇ ਵਿੱਚ ਸਾਡੇ ਇਲਾਕੇ ਨੂੰ ਸਾਫ ਸੁਥਰਾ ਇਲਾਕਾ ਮੰਨਿਆ ਜਾਂਦਾ ਹੈ ਇਸ ਕਰਕੇ ਘਰ ਦੇ ਆਲੇ ਦੁਆਲੇ ਸਾਨੂੰ ਸਭ ਨੂੰ ਸਫਾਈ ਰੱਖਣੀ ਚਾਹੀਦੀ ਹੈ ਅਤੇ ਸਾਫ ਸੁਥਰਾ ਹੀ ਘਰ ਮੁਹੱਲਾ ਸਭ ਕੁਝ ਸਾਨੂੰ ਸਾਫ ਸੁਥਰਾ ਹੀ ਚੰਗਾ ਰੱਖਣਾ ਚਾਹੀਦਾ ਹੈ ਧੰਨਵਾਦ